ਪੁਰਾਣੇ ਯੁੱਗ ਵਿੱਚ ਰੇਡੀਓ ਦੇ ਮਾਧਿਅਮ ਰਾਹੀਂ ਦਿਨ ਭਰ ਦੀਆਂ ਖਬਰਾਂ ਨੈਸ਼ਨਲ ਅਤੇ ਇੰਟਰਨੈਸ਼ਨਲ ਖਬਰਾਂ ਦਾ ਸਮੇਂ ਮੁਤਾਬਿਕ ਪਤਾ ਲੱਗਦਾ ਸੀ ਜੋ ਕਿ ਬਹੁਤ ਹੀ ਵਧੀਆ ਸੀ ਜਿਸ ਵਿੱਚ ਕੋ ਕਿਸੇ ਵੀ ਤਰ੍ਹਾਂ ਦਾ ਝੂਠ ਥਾਂ ਜਾਂ ਕੋਈ ਫੇਕ ਖਬਰਾਂ ਨਹੀਂ ਹੁੰਦੀਆਂ ਸੀ ਕਿਉਂਕਿ ਇੱਕ ਉਹ ਸਾਰੀ ਦਿਹਾੜੀ ਦੇ ਨਿਚੋੜ ਕੱਢ ਕੇ ਤਾਂ ਆਪਾਂ ਨੂੰ ਦੱਸੀਆਂ ਜਾਂਦੀਆਂ ਸਨ ਪਰ ਅੱਜ ਦੇ ਨਵੇਂ ਮੀਡੀਏ ਵਿੱਚ ਜੇ ਕਿਸੇ ਦੀ ਅਫਵਾਹ ਵੀ ਹੈ ਜਾਂ ਕਿਸੇ ਦੀ ਕੋਈ ਵਾਇਰਲ ਵੀਡੀਓ ਵੀ ਹੈ ਉਸ ਨੂੰ ਵੀ ਇੱਕ ਬੜੇ ਹੀ ਅਨੋਖੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਜੋ ਕਿ ਬਾਅਦ ਵਿੱਚ ਕੋਈ ਨਾ ਕੋਈ ਗੱਲ ਹੋਰ ਨਿਕਲਦੀ ਹੈ ਅਤੇ ਖਬਰ ਕੋਈ ਹੋਰ ਹੋ ਜਾਂਦੀ ਮੇਰੇ ਹਿਸਾਬ ਨਾਲ ਜਿਹੜਾ ਪੁਰਾਣਾ ਮੀਡੀਆ ਸੀ ਉਹ ਬਹੁਤ ਹੀ ਵਧੀਆ ਸੀ ਨਵਾਂ ਮੀਡੀਆ ਜੇ ਆਪਾਂ ਮੰਨੀਏ ਨਵੇਂ ਮੀਡੀਏ ਦੀ ਜੇ ਤਾਂ ਸ ਸਹੀ ਖਬਰ ਦੀ ਸਹੀ ਪੜਚੋਲ ਕਰਕੇ ਉਹਨਾਂ ਨੇ ਤੁਹਾਨੂੰ ਖਬਰ ਦਿੱਤੀ ਹੈ ਤਾਂ ਤਾਂ ਵੈਲ ਨ ਇਨ ਗੁੱਡ ਬੈਸਟ ਪਰੰਤੂ ਜੇ ਉਹਨਾਂ ਨੇ ਕਿਸੇ ਦੀ ਚੱਕੀ ਚਕਾਈ ਜਾਂ ਕਿਸੇ ਦੀ ਕਹੀ ਕਹਾਈ ਗੱਲ ਜਾਂ ਕੋਈ ਖਬਰ ਦੱਸ ਤੀ ਉਹਦਾ ਕੋਈ ਵੀ ਫਾਇਦਾ ਨਹੀਂ ਜੋ ਕਿ ਕਈ ਵਾਰੀ ਕਿਸੇ ਦੀ ਜਾਨ ਲੇਵਾ ਜ਼ਿੰਦਗੀ ਵੀ ਲੈ ਲੈਂਦਾ ਜੋ ਕਿ ਫੇਕ ਇੱਕ ਨਿਊਜ਼ ਦੇ ਤਰ੍ਹਾਂ ਉਹ ਆਪਾਂ ਨੂੰ ਪੇਸ਼ ਕਰਕੇ ਬੰਦੇ ਨੂੰ ਅਪਰਾਧੀ ਬਣਾ ਦਿੰਦੇ ਹਨ